ਸਤਿ ਸ਼੍ਰੀ ਅਕਾਲ ਮੇਰਾ ਨਾਮ ਪ੍ਰਿਆ ਹੈ ਜਿਵੇਂ ਕਿ ਤੁਸੀਂ ਪੁੱਛ ਰਹੇ ਹੋ ਮਨੋਰਜਨ ਕਿਵੇਂ ਬਦਲਿਆ ਹੈ ਅਤੇ ਜੇ ਮੈਂ ਗੱਲ ਕਰਾਂ ਕਿ ਮਨੋਰੰਜਨ ਮਨੋਰੰਜਨ ਵਿੱਚ ਬਹੁਤ ਸਾਰੇ ਬਦਲਾਵ ਆਏ ਹਨ ਪਹਿਲੇ ਰੇਡੀਓ ਦਾ ਸਮੇਂ ਸੀ ਜਿਵੇਂ ਕਿ ਰੇਡੀਓ ਵਿੱਚ ਸਮਾਚਾਰ ਆਉਂਦੇ ਸੀ ਗਾਣੇ ਆਉਂਦੇ ਸੀ ਅਤੇ ਸਾਡੇ ਪਰਿਵਾਰ ਵਿੱਚ ਹੁੰਦਾ ਸੀ ਕਿ ਰੇਡੀਓ ਦਾ ਸਮਾਂ ਮਤਲਬ ਇਕੱਠੇ ਪਰਿਵਾਰ ਦੇ ਬੈਠਣ ਦਾ ਸਮਾਂ ਹੁੰਦਾ ਸੀ ਸਾਰੇ ਇਕੱਠੇ ਬੈਠ ਕੇ ਰੇਡੀਓ ਲਗਾ ਲੈਂਦੇ ਸੀ ਅਤੇ ਖਾਣਾ ਖਾਂਦੇ ਸੀ ਹੱਸਦੇ ਸੀ ਖੇਡਦੇ ਸੀ ਅਤੇ ਸਮਾਚਾਰ ਸੁਣਦੇ ਸੀ ਅਤੇ ਗੱਲਾਂ ਕਰਦੇ ਸੀ ਸ਼ਾਮ ਦੇ ਸਮੇਂ ਜ਼ਿਆਦਾਤਰ ਰੇਡੀਓ 'ਤੇ ਸਮਾਚਾਰ ਸੁਣਿਆ ਜਾਂਦਾ ਸੀ ਅਤੇ ਸਾਡੇ ਦਾਦਾ ਜੀ ਵੀ ਬੈਠ ਕੇ ਸੁਣਦੇ ਸੀ ਅਤੇ ਹੁਣ ਦੇ ਸਮੇਂ ਵਿੱਚ ਟੀ ਵੀ ਆ ਗਿਆ ਹੈ ਕੰਪਿਊਟਰ ਆ ਗਿਆ ਹੈ ਜਿਹਦੇ ਨਾਲ ਕੀ ਹੋਇਆ ਟੀ ਵੀ ਦਾ ਤੱਕ ਦਾ ਸਮਾਂ ਵੀ ਵਧੀਆ ਸੀ ਉਹ ਵੀ ਇਕੱਠੇ ਬੈਠ ਕੇ ਦੇਖਣ ਵਾਲਾ ਸਮਾਂ ਸੀ ਬੱਟ ਜਦੋਂ ਦੇ ਕੰਪਿਊਟਰ ਵਗੈਰਾ ਆ ਗਏ ਹੈ ਉਦੋਂ ਤਾਂ ਦਾ ਇਕੱਠੇ ਬੈਠਣ ਦਾ ਸਮਾਂ ਜਿਹੜਾ ਹੈ ਉਹ ਘੱਟ ਹੋ ਗਿਆ ਹੈ ਲੋਕ ਆਪਣੇ ਆਪਣੇ ਅਲੱਗ ਅਲੱਗ ਹੋ ਕੇ ਬੈਠਣਾ ਸ਼ੁਰੂ ਕਰ ਗਏ ਹਨ ਅਤੇ ਮੋਬਾਈਲਾਂ ਕਰਕੇ ਹਰ ਬੱਚੇ ਦੇ ਹੱਥ ਵਿੱਚ ਅੱਜ ਕੱਲ ਮੋਬਾਈਲ ਹੈ ਅਤੇ ਮੋਬਾਇਲ ਵਿੱਚ ਹੀ ਰੁੱਝੇ ਰਹਿੰਦੇ ਹਨ ਇਕੱਠੇ ਬੈਠਣ ਦਾ ਤਾਂ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਹੈ ਅਤੇ ਮਨੋਰੰਜਨ ਜਿੰਨਾ ਆਸਾਨ ਹੋ ਗਿਆ ਹੈ ਮਨੋਰੰ ਮਨੋਰੰਜਨ ਕਰਨਾ ਆਪਣਾ ਓਨਾ ਹੀ ਇਹ ਆਪਣਿਆਂ ਤੋਂ ਸਾਨੂੰ ਦੂਰ ਕਰਦਾ ਜਾ ਰਿਹਾ ਹੈ ਧੰਨਵਾਦ ਜੀ